ਜੀ ਹਾਂ ਅਸੀਂ ਹਾਲ ਹੀ ਨਵੇਂ ਅਪੈਟ ਵਿੱਚ ਅਪਾਟਮੈਂਟ ਵਿੱਚ ਚਲੇ ਗਏ ਹਾਂ ਅਤੇ ਆਪਣੇ ਗੈਸ ਬੁਕਿੰਗ ਦੀ ਡਿਲੀਵਰੀ ਦਾ ਸਹੀ ਪਤਾ ਆਪ ਦੀ ਏਜੈਂਸੀ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਇਸ ਲਈ ਬੁਕਿੰਗ ਰੈਫਰੈਂਸ ਨੰਬਰ ਸਾਡਾ ਇੱਕ ਚਾਰ ਤਿੰਨ ਛੇ ਸੱਤ ਹੈ ਅਤੇ ਅਧਾਰ ਕਾਰਡ ਨੰਬਰ ਹੈ ਸਾਡਾ ਚਾਰ ਅੱਠ ਨੌਂ ਨੌਂ ਅਤੇ ਨਵਾਂ ਪਤਾ ਸਾਡਾ ਹੈ ਮਾਡਲ ਟਾਊਨ ਸਟ੍ਰੀਟ ਨੰਬਰ ਅੱਠ